ਹਾਂਜੀ ਸਾਡੇ ਭਾਂਡਿਆਂ ਦੀ ਕਲੈਕਸ਼ਨ ਬਹੁਤ ਵਧੀਆ ਮਿਲੀ ਹੈ ਸਾਡੇ ਭਾਂਡੇ ਜਿਵੇਂ ਆਪਣੇ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਆ ਭਾਂਡੇ ਜਿਵੇਂ ਸਟੀਲ ਦੇ ਹੋ ਗਏ ਕੱਚ ਦੇ ਹੋਗੇ ਚੀਨੀ ਦੇ ਹੋ ਗਏ ਡਿਨਰ ਸੈੱਟ ਹੋ ਗਏ ਕੌਲੀਆਂ ਪਲੇਟਾ ਚਾਕੂ ਐਰਾ ਵਗੈਰਾ ਦੇ ਭਾਂਡੇ ਹੁੰਦੇ ਹਨ ਜਿਵੇਂ ਕੀ ਸਾਡਾ ਮੁਕਤਸਰ ਦੇ ਵਿੱਚ ਮੇਲਾ ਲੱਗਦਾ ਹੈ ਤਾਂ ਮੈਂ ਅਲੱਗ ਅਲੱਗ ਤਰ੍ਹਾਂ ਦੇ ਭਾਂਡੇ ਲੈਕੇ ਆਂਦੀ ਹਾਂ ਜਿਵੇਂ ਮੁਕਤਸਰ ਦੇ ਵਿੱਚ ਕੱਪ ਪਲੇਟਾ ਚਾਕੂ ਡਿਨਰ ਸੈਟ ਵਗੈਰਾ ਬਹੁਤ ਵਧੀਆ ਮਿਲਦੇ ਹਨ ਤੇ ਇਹਨਾਂ ਦੀ ਬਹੁਤ ਵਧੀਆ ਵਰਾਇਟੀ ਹੁੰਦੀ ਹੈ ਅਤੇ ਜਿਵੇਂ ਕਿ ਇਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਰੱਖਣੀ ਪੈਂਦੀ ਹੈ ਜਿਵੇਂ ਕਿ ਚੀਨੀ ਦੇ ਭਾਂਡੇ ਹੋ ਗਏ ਇਹਨਾਂ ਨੂੰ ਨਾਲ ਦੀ ਨਾਲ ਧੋਣਾ ਪੈਂਦਾ ਹੈ ਤੇ ਨਾਲ ਦੀ ਨਾਲ ਸੁਕਾ ਕੇ ਸੰਭਾਲਣਾ ਪੈਂਦਾ ਹੈ ਕਿਉਂਕਿ ਬੱਚਿਆਂ ਦੇ ਹੱਥ ਲੱਗ ਜਾਣ ਤਾਂ ਕਈ ਵਾਰ ਟੁੱਟਣ ਦਾ ਡਰ ਹੁੰਦਾ ਹੈ ਜਾਂ ਬੱਚਿਆਂ ਨੂੰ ਚੋਟ ਵੀ ਲੱਗ ਸਕਦੀ ਹੈ ਅਤੇ ਜਿਹੜੇ ਮੰਨ ਕੇ ਚਲੀਏ ਇਹਨਾਂ ਦਾ ਪ੍ਰਦਰਸ਼ਿਤ ਜਦੋਂ ਸਾਡੇ ਘਰੇ ਗੈਸਟ ਆਉਂਦੇ ਆ ਜਾਂ ਕਈ ਵਾਰ ਰਿਸ਼ਤੇਦਾਰ ਆਉਂਦੇ ਆ ਤੇ ਉਦੋਂ ਮੈਂ ਚੀਨੀ ਦੇ ਜਾ ਕੱਚ ਦੇ ਡਾਂਡੇ ਯੂਜ ਕਰਦੀ ਆ ਵੀ ਜਿਆਦਾਤਰ ਰਿਸ਼ਤੇਦਾਰ ਕਈ ਵਾਰ ਜਦੋਂ ਆਉਂਦੇ ਆ ਪਿੱਤਲ ਦੇ ਡਾਂਡੇ ਵੀ ਭਾਂਡੇ ਹੁੰਦੇ ਆ ਤੇ ਉਹਨਾਂ ਵਿੱਚ ਪਾਣੀ ਫੜਾ ਦਈਦਾ ਤੇ ਜਿਹੜੇ ਚੀਨੀ ਦੇ ਭਾਂਡੇ ਹੁੰਦੇ ਉਹਨਾਂ ਵਿੱਚ ਰੋਟੀ ਫੜਾ ਦਈਦੀ ਆ